ਹੈਲੋ ਬੋਲਦੇ ਪਏ ਜੇ ਅਤੇ ਮੈਂ ਮੈਂ ਹਰਿਆਣੇ ਤੋਂ ਬੋਲਦੀ ਪਈ ਹਾਂ ਅਤੇ ਮੈਂ ਇੱਥੇ ਪੰਜਾਬ ਘੁੰਮਣਾ ਚਾਹੁੰਦੀ ਹਾਂ ਤਰਨ ਤਾਰਨ ਦੇ ਲਾਗੇ ਲਾਗੇ ਜਿੱਦਾਂ ਪੱਟੀ ਹੋ ਗਿਆ ਫਿਰੋਜ਼ਪੁਰ ਹੋ ਗਿਆ ਜੀਰਾ ਹੋ ਗਿਆ ਇਸ ਤਰ੍ਹਾਂ ਮੈਂ ਪੁੱਛਣਾ ਸੀਗਾ ਕਿ ਇੱਥੋਂ ਅਤੇ ਇਹਨਾਂ ਦਾ ਕਿਸ ਤਰ੍ਹਾਂ ਹੈਗਾ ਹੈ ਜਾਂਦੀਆਂ ਹੈ ਹਾਂਜੀ ਹਾਂਜੀ ਹਾਂਜੀ

ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ

ਓਕੇ ਜੀ ਅਤੇ ਮੈਮ ਮੈਂ ਵਾਪਸ ਇੱਥੋਂ ਸਿੱਧੀ ਟਰੇਨ ਜਾ ਸਕਦੀ ਹਾਂ ਹਰਿਆਣੇ ਤੋਂ ਹਰਿਆਣੇ ਨੂੰ

ਹਾਂਜੀ

ਹਾਂਜੀ ਹਾਂਜੀ ਓਕੇ ਹਾਂਜੀ ਓਕੇ ਜੀ ਨਹੀਂ ਬਸ ਮੈਮ ਥੈਂਕ ਯੂ ਹਾਂਜੀ ਬਸ ਓਕੇ ਜੀ